ਇਹੋ ਜਿਹੀਆਂ ਕਈ ਸਾਰੀਆਂ ਚੀਜ਼ਾਂ ਹਨ ਜੋ ਕਿ ਪੰਜਾਬ ਵਿੱਚ ਦੇਖਣ ਵਾਲੀਆਂ ਹਨ ਪਰ ਉਹਨਾਂ ਵਿੱਚੋਂ ਕੁਛ ਖਾਸ ਹੈ ਖਾਲਸਾ ਕੋਲੇਜ ਅਕਾਲ ਤਖ਼ਤ ਰਣਜੀਤ ਸਾਗਰ ਡੈਮ ਅਤੇ ਵਿਰਾਸਤ ਏ ਖਾਲਸਾ ਵਿਰਾਸਤ ਏ ਖਾਲਸਾ ਮੈਂ ਆਪਣੇ ਪਰਿਵਾਰ ਨਾਲ ਆਪ ਦੇਖਿਆ ਹੈ ਅਤੇ ਇਹ ਬਹੁਤ ਹੀ ਸੁੰਦਰ ਜਗ੍ਹਾ ਹੈ ਮੈਂ ਇਸ ਜਗ੍ਹਾ ਨੂੰ ਜਦੋਂ ਦੇਖਿਆ ਅਤੇ ਮੈਨੂੰ ਬਹੁਤ ਹੀ ਸੁੰਦਰ ਅਨੁਭੂਤੀ ਹੋ ਗਈ ਇਸ ਜਗ੍ਹਾ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਬੀਤਿਆ ਹੋਇਆ ਕੱਲ੍ਹ ਕਿੰਨਾਂ ਔਖਾ ਸੀ ਅਤੇ ਸਾਡੇ ਪੁਰਵਜਾਂ ਨੇ ਕਿਸ ਕਦਰ ਸ਼ਹੀਦੀ ਦਿੱਤੀ ਹੈ ਇਹ ਪੰਜਾਬ ਅਤੇ ਇਸ ਭਾਰਤ ਨੂੰ ਆਜ਼ਾਦ ਕਰਾਉੁਣ ਲਈ ਰਣਜੀਤ ਸਾਗਰ ਡੈਮ ਜੰਮੂ ਐਂਡ ਕਸ਼ਮੀਰ ਵਿੱਚ ਸਥਿਤ ਹੈ ਅਤੇ ਇੱਕ ਬਹੁਤ ਹੀ ਵੱਡਾ ਡੈਮ ਹੈ ਜਿਹਦੇ ਰਾਹੀਂ ਕਈ ਸਾਰਿਆਂ ਗਾਂ ਗਾਂਓ ਵਿੱਚ ਪਾਣੀ ਭੇਜਿਆਂ ਜਾਂਦਾ ਹੈ ਅਤੇ ਇਹ ਬਿਜਲੀ ਬਣਾਉਣ ਦੇ ਕੰਮ ਵੀ ਆਉਂਦਾ ਹੈ